ਹੈਲੋ ਕੀ ਹਾਲ ਚੰਦਨ ਵੀਰ ਕੀ ਕਰਦੇ ਅੱਜ ਕੱਲ੍ਹ ਕਿਹੜੀ ਗੇਮ ਅੱਛਾ ਕੁਛ ਨਹੀਂ ਫੁੱਟਬੋਲ ਹੀ ਆ ਫੁੱਟਬੋਲ ਖੇਡਦਾ ਰਹਿੰਦਾ ਹੋਰ ਕੀ ਕਰਨਾ ਚਾਰ ਸਾਲ ਹੋ ਗਏ ਆ ਯਾਰ ਉਹ ਕਿੱਥੇ ਟੂਰਨਾਮੈਂਟ ਲੈਣਾ ਕੋਈ ਅਕੈਡਮੀ ਨਹੀਂ ਲੱਭਣ ਦੀ ਆ ਅਕੈਡਮੀ ਬਹੁਤ ਲੱਭੀਆਂ ਕੋਈ ਚੱਜ ਦੀ ਅਕੈਡਮੀ ਨਹੀਂ ਲੱਭਣ ਦੀ ਕਿੱਦਾਂ ਠੀਕ ਆ ਠੀਕ ਆ ਗੇਮ ਤਾਂ ਬਹੁਤ ਵਧੀਆ ਯਾਰ ਚਾਰ ਸਾਲ ਦੀ ਬਹੁਤ ਵਧੀਆ ਗੇਮ ਹੋ ਗਈ ਆਪਣੀ ਠੀਕ ਆ

ਠੀਕ ਆ ਆ ਜਾਂਦਾ ਚਲੋ ਕੋਈ ਨਾ ਠੀਕ ਆ ਮੈਂ ਆ ਜਾਂਦਾ ਅੱਜ ਹੀ ਆ ਜਾਂਦਾ ਮੈਂ ਠੀਕ ਆ